ਮੇਰਾ ਨਾਮ ਨੈਨਸੀ ਹੈ ਮੈਂ ਤੁਹਾਨੂੰ ਪਿੰਡਾਂ ਵਿੱਚੋਂ ਖੇਡਾਂ ਖੇਡਣ ਨਾਲ ਵਿਅਕਤੀਆਂ ਵਿੱਚ ਕਿਹੜੇ ਕਿਹੜੇ ਹੁਨਰ ਆ ਜਾਂਦੇ ਹਨ ਮੈਂ ਉਹਨਾਂ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਪਿੰਡਾਂ ਵਿੱਚ ਖੇਡਾਂ ਖੇਡਣ ਨਾਲ ਵਿਅਕਤੀ ਵਿੱਚ ਬਹੁਤ ਸਾਰੇ ਹੁਨਰ ਆ ਜਾਂਦੇ ਹਨ ਜਿਵੇਂ ਕਿ ਕੁਸ਼ਤੀ ਫੁੱਟਬੋਲ ਖੋ ਖੋ ਕਬੱਡੀ ਆਦਿ ਖੇਡ ਖੇਡਾਂ ਵੀ ਖੇਡਣ ਨਾਲ ਬਹੁਤ ਸਾਰੇ ਹੁਨਰ ਆ ਜਾਂਦੇ ਹਨ ਅਤੇ ਕਈ ਅਤੇ ਸਾਡੀ ਬੋਡੀ ਵੀ ਸਿਹਤਮੰਦ ਰਹਿੰਦੀ ਹੈ ਅਤੇ ਸਾਡੀ ਬੋਡੀ ਦੇ ਸਾਰੇ ਪਾਰਟ ਵੀ ਸਹੀ ਢੰਗ ਨਾਲ ਕੰਮ ਕਰਦੇ ਹਨ ਜਿਹੜੇ ਚੰਗੇ ਪਲੇਅਰ ਹੁੰਦੇ ਹਨ ਉਹਨਾਂ ਨੂੰ ਕੋਚ ਵੀ ਬਣਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਨੂੰ ਸਰਕਾਰ ਸਰਕਾਰੀ ਨੌਕਰੀ ਵੀ ਦੇ ਦਿੰਦੀ ਹੈ ਖੇਡਾਂ ਖੇਡਣ ਨਾਲ ਸਾਡੇ ਸਰੀਰ ਵਿੱਚ ਚੁਸਤੀ ਆ ਜਾਂਦੀ ਹੈ ਕਈ ਬੱਚੇ ਫਿਰ ਕੋਚ ਤੋਂ ਖੇਡਣ ਬਾਰੇ ਹੁਨਰ ਲੈਂਦੇ ਹਨ ਅਤੇ ਉਹ ਵੀ ਵਧੀਆ ਢੰਗ ਨਾਲ ਦੱਸਦੇ ਹਨ ਖੇਡਾਂ ਨਾਲ ਪਿੰਡਾਂ ਦੇ ਜਾਂ ਹੋਰ ਕਈ ਦੇਸ਼ਾਂ ਦੇ ਖੇਡਣ ਵਾਲੇ ਬੱਚਿਆਂ ਵਿੱਚ ਬਹੁਤ ਸਾਰੇ ਹੁਨਰ ਆ ਜਾਂਦੇ ਹਨ ਜਿਵੇਂ ਕਿ ਕੁਸ਼ਤੀ ਖੇਡਣ ਵਾਲਿਆਂ ਵਿੱਚ ਕੁਸ਼ਤੀ ਦੇ ਹੁਨਰ ਆ ਜਾਂਦੇ ਹਨ ਫੁੱਟਬੋਲ ਖੇਡਣ ਵਾਲਿਆਂ ਦੇ ਵਿੱਚ ਫੁੱਟਬੋਲ ਦੇ ਹੁਨਰ ਆ ਜਾਂਦੇ ਹਨ ਅਤੇ ਖੋ ਖੋ ਖੇਡਣ ਵਾਲਿਆਂ ਖਿਡਾਰੀਆਂ 'ਚ ਖੋ ਖੋ ਦੇ ਹੁਨਰ ਆ ਜਾਂਦੇ ਹਨ ਅਤੇ ਕਬੱਡੀ ਖੇਡਣ ਵਾਲਿਆਂ ਦੇ ਖਿਡਾਰੀਆਂ ਦੇ ਕਬੱਡੀ ਦੇ ਹੁਨਰ ਆ ਜਾਂਦੇ ਹਨ